ਲੋਕ ਗੀਤਾਂ ਵਿੱਚੋਂ ਮੈਨੂੰ ਬਹੁਤ ਸਾਰੇ ਲੋਕ ਗੀਤ ਪਸੰਦ ਹਨ ਪਰ ਮੇਰਾ ਸਭ ਤੋਂ ਪਸੰਦੀਦਾ ਲੋਕ ਗੀਤ ਬਾਬਲ ਦਾ ਵਿਹੜਾ ਹੈ ਇਸ ਦਾ ਕਾਰਨ ਇਹ ਹੈ ਕਿ ਮੈਂ ਇੱਕ ਧੀ ਹਾਂ ਅਤੇ ਆਪਣੇ ਬਾਬਲ ਦੇ ਵਿਹੜੇ ਨੂੰ ਛੱਡਣ ਵੇਲੇ ਮੈਨੂੰ ਬਹੁਤ ਤਕਲੀਫ ਹੋਈ ਜਦ ਮੇਰਾ ਵਿਆਹ ਹੋਇਆ ਸੀ ਹਾਂ ਮੈਂ ਇਸ ਗੀਤ ਨੂੰ ਗਾਇਆ ਹੈ ਇਸ ਗੀਤ ਨੂੰ ਮੈਂ ਆਪਣੇ ਵਿਆਹ ਦੇ ਸਮੇਂ ਵਿੱਚ ਆਪਣੇ ਬਾਬਲ ਅਤੇ ਆਪਣੇ ਮਾਂ ਬਾਪ ਦੇ ਨਾਲ ਬੈਠ ਕੇ ਇਸ ਗੀਤਾ ਦਾ ਗੁਣਗਾਨ ਕੀਤਾ ਇਸ ਗੀਤ ਨੂੰ ਗਾਉਂਦੇ ਸਮੇਂ ਮੇਰੇ ਬਚਪਨ ਦੀਆਂ ਯਾਦਾਂ ਮੇਰੇ ਭੈਣ ਭਰਾ ਦੀਆਂ ਯਾਦਾਂ ਨਾਲ ਜੁੜੀਆਂ ਹੋਈਆਂ ਹਨ ਇਸ ਗੀਤ ਦੇ ਵਿੱਚ ਇਸ ਗੀਤ ਦੇ ਨਾਲ ਮੈਂ ਆਪਣੇ ਬਚਪਨ ਦੇ ਸਾਰੇ ਉਹਨਾਂ ਖੂਬਸੂਰਤ ਪਲਾਂ ਨੂੰ ਯਾਦ ਕੀਤਾ ਜੋ ਮੈਂ ਆਪਣੇ ਭੈਣ ਭਰਾ ਤਾਏ ਚਾਚੇ ਮਾਸੀਆਂ ਭੂਆ ਮਾਮੇ ਮਾਮੀਆਂ ਨਾਲ ਸਮਾਂ ਬਿਤਾਇਆ ਸੀ ਅਤੇ ਆਪਣੇ ਬਾਬਲ ਦੇ ਨਾਲ ਮੈਂ ਹਰ ਸਮੇਂ ਨੂੰ ਹਰ ਸਮਾਂ ਜੋ ਮੈਂ ਆਪਣੇ ਬਾਬਲ ਨਾਲ ਬਿਤਾਇਆ ਉਸਨੂੰ ਬਤੀਤ ਕੀਤਾ ਅਤੇ ਉਸ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕੀਤਾ ਜਿਸ ਸਮੇਂ ਮੈਂ ਇਹ ਗੀਤ ਗਾ ਰਹੀ ਸੀ ਉਸ ਦੀਆਂ ਯਾਦਾਂ ਹਾਲੇ ਤੱਕ ਮੇਰੇ ਦਿਲ ਵਿੱਚ ਹਨ ਅਤੇ ਮੈਂ ਸਾਂਝੀਆਂ ਕੀਤੀਆਂ ਤੁਹਾਡੇ ਨਾਲ